ਹੈਲੋ ਨਮਸਕਾਰ ਮੈਮ ਹਾਂਜੀ ਮੈਮ ਮੈਂ ਨਾ ਆਊਟ ਆਫ ਸਟੇਟ ਹਾਂ ਸਟੇਟ ਤੋਂ ਆਈ ਹਾਂ ਜੀ ਮੈਂ ਨਾ ਇੱਥੇ ਫੋਕ ਡਾਂਸ 'ਚ ਜੀ ਪਰਟੀਸੀਪੇਟ ਕਰਨਾ ਸੀ ਮੈਮ ਮੈਂ ਮਤਲਬ ਮੈਨੂੰ ਬਿਲਕੁਲ ਵੀ ਅਵੇਅਰ ਨਹੀਂ ਹੈਗੀ ਕਿ ਮੈਂ ਵੀ ਮਤਲਬ ਮੈਨੂੰ ਬਿਲਕੁਲ ਵੀ ਨੌਨ 'ਚ ਨਹੀਂ ਹਾਂ ਮੈਂ ਕਿਵੇਂ ਵੀ ਹਾਂਜੀ ਹਾਂਜੀ ਹਾਂਜੀ

ਹਾਂਜੀ ਮੈਮ ਉਹਦੇ ਹਾਂਜੀ ਉਹਦੇ ਲਈ ਫਿਰ ਮੈਮ ਡਰੈਸ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਇੱਥੇ ਮੈਂ ਇੱ ਮਤਲਬ ਕਾਫ਼ੀ ਮਤਲਬ ਜਨਾਨੀਆਂ ਨੂੰ ਕੁੜੀਆਂ ਨੂੰ ਮਤਲਬ ਮੈਂ ਗਾਗਰਾ ਵੀਅਰ ਕਰਦੇ ਦੇਖਿਆ ਮਤਲਬ ਉਹ ਉਹ ਵੀ ਪਹਿਨ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਜੂਲਰੀ ਵਗੈਰਾ ਵੀ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ ਮੈਮ ਗਲ 'ਚ ਕੀ ਪਾਈਦਾ ਹੁੰਦਾ ਜੀ ਗਲ ਐਵੇਂ ਹੀ ਰੱਖਣਾ ਹੁੰਦਾ ਹਾਂਜੀ ਹਾਂਜੀ ਓਕੇ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੂੰ ਹੂੰ

ਹਾਂਜੀ ਠੀਕ ਹਾਂਜੀ ਹਾਂਜੀ ਓਕੇ ਮੈਮ ਹਾਂਜੀ

ਠੀਕ ਹੈ ਮੈਮ ਥੈਂਕ ਯੂ ਮੈਮ ਓਕੇ ਜੀ